ਸਾਈਕਲ ਚਲਾਉਣਾ ਬਹੁਤ ਵਧੀਆ ਕੰਮ ਆ ਮੈਂ ਸਾਰੇ ਆਪਦੇ ਕੰਮਕਾਰ ਸਾਈਕਲ ਦੇ ਉੱਤੇ ਹੀ ਕਰਦਾ ਆ ਕਿਉਂ ਸਿਲੰਡਰ ਲਿਆਉਣਾ ਸਬਜੀ ਭਾਜੀ ਲਿਆਉਣੀ ਕੰਮ 'ਤੇ ਜਾਣਾ ਕੰਮ ਤੋਂ ਆਉਣਾ ਤੇ ਮੈਨੂੰ ਇਸ ਕਰਕੇ ਬਹੁਤ ਚੰਗਾ ਲੱਗਦਾ ਇਹ ਕਿਸ ਦੇ ਨਾਲ ਗੋਡਿਆਂ ਨੂੰ ਵੀ ਮਜਬੂਤੀ ਮਿਲਦੀ ਹੈ ਸਰੀਰ ਫਿਟ ਫਾਟ ਰਹਿੰਦਾ ਹੈ ਕਿਉਂਕਿ ਜਦੋਂ ਮੈਂ ਇਹਦੀ ਸੰਭਾਲ ਕਰਦਾ ਆ ਚੈਨ ਨੂੰ ਗਰੀਸ ਕਰਦਿਆਂ ਧੋਨਾ ਸਵੇਰੇ ਉੱਠ ਕੇ ਸਾਰਾ ਕੁਝ ਕਰਕੇ ਚੈੱਕ ਕਰਕੇ ਸਾਫ ਸੂਫ ਕਰਕੇ ਫਿਰ ਲੈ ਕੇ ਜਾਨਾ ਇਸ ਕਰਕੇ ਮੈਨੂੰ ਕੋਈ ਤਕਲੀਫ ਨਹੀਂ ਆਉਂਦੀ ਸਾਈਕਲ ਚਲਾਉਂਦਿਆਂ ਕਿਉਂਕਿ ਸਾਈਕਲ ਬਹੁਤ ਵਧੀਆ ਇੱਕ ਸ਼ੈ ਆ ਜਿਸ ਕਾਰਨ ਮੈਂ ਸਾਈਕਲ ਦੀ ਹਮੇਸ਼ਾ ਵਰਤੋਂ ਕਰਦਾ ਇਸ ਤੇ ਮੈਨੂੰ ਚੰਗਾ ਬਹੁਤ ਲੱਗਦਾ ਹੈ ਤੀਹ ਪੈਂਤੀ ਸਾਲ ਹੋ ਗਏ ਮੈਨੂੰ ਸਾਈਕਲ ਚਲਾਉਂਦਿਆਂ ਨੂੰ ਇਤੇ ਆਉਣਾ ਕੰਮ 'ਤੇ ਤੇ ਇਸ 'ਤੇ ਹੀ ਕੰਮ 'ਤੇ ਜਾਨਾ ਆ